ਹੈਲੋ ਕੀ ਹਾਲ ਚਾਲ ਨੇ ਕੁਲਦੀਪ ਸਿੰਘ ਜੀ ਬੋਲਦੇ ਹਾਂਜੀ ਕੁਲਦੀਪ ਸਿੰਘ ਆਪਣਾ ਮੈਨੂੰ ਇੱਕ ਵਧੀਆ ਰੈਸਟੋਰੈਂਟ ਦੱਸੋ ਜਿੱਥੋਂ ਆਪਣੇ ਅੰਮ੍ਰਿਤਸਰ ਦੇ ਸ ਸੋਹਣੇ ਖਾਣੇ ਮਿਲ ਸਕਦੇ ਹੋਣ ਔਰ ਉਹ ਸਾਡੇ ਕੋਲ ਕੋਈ ਪ੍ਰਾਹੁਣੇ ਆਏ ਹੋਏ ਨੇ ਜੋ ਅੰਮ੍ਰਿਤਸਰ ਦੀਆਂ ਲਜ਼ੀਜ਼ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਲੱਗੇ ਓ ਓਹ ਚੱਖਣਾ ਚਾਹੁੰਦੇ ਨੇ ਅਤੇ ਉਹਨਾਂ ਦਾ ਕਿਰਪਾ ਕਰਕੇ ਸਾਨੂੰ ਕੋਈ ਵਧੀਆ ਹੋਟਲ ਦਾ ਜੇ ਨਾਮ ਪਤਾ ਹੈ ਤਾਂ ਤੁਸੀਂ ਦੱਸੋ ਜੀ ਤੁਸੀਂ ਤਾਂ ਬਾਹਰ ਆਉਂਦੇ ਜਾਂਦੇ ਰਹਿੰਦੇ ਹੋ ਅਤੇ ਉਸਦਾ ਲ ਨਾਮ ਲੋਕੇਸ਼ਨ ਪਤਾ ਕਿੱਥੇ ਪੈਂਦਾ ਹੈ ਤਾਂ ਜ਼ਰੂਰ ਦੱਸਣਾ ਅਤੇ ਇਹਨਾਂ ਵਿੱਚੋਂ ਜਿਵੇਂ ਤੁਸੀਂ ਬਰਦਰ ਢਾਬੇ ਬਾਰੇ ਦੱਸ ਰਹੇ ਹੋ ਇੱਥੇ ਪੰਜਾਬੀ ਦੀਆਂ ਜਿਹੜੀਆਂ ਵੱਖ ਵੱਖ ਡਿਸ਼ਿਜ਼ ਨੇ ਕੁਲਚੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਇਹ ਵਧੀਆ ਮਿਲਦੇ ਨੇ ਠੀਕ ਆ ਅਤੇ ਜੇਕਰ ਇਹ ਵਧੀਆ ਮਿਲਦੇ ਨੇ ਤਾਂ ਇਹਨਾਂ ਦੀ ਕੀਮਤ ਵੀ ਰੇਟਿੰਗ ਦੇ ਹਿਸਾਬ ਨਾਲ ਠੀਕ ਹੈ ਚਲੋ ਬਹੁਤ ਵਧੀਆ ਅਤੇ ਜੇ ਅਸੀਂ ਦਸ ਬੰਦਿਆਂ ਦਾ ਮੰਗਵਾਉਣਾ ਹੋਵੇ ਤਾਂ ਉਹ ਕਿਵੇਂ ਘਰ ਭੇਜ ਸਕਦੇ ਨੇ ਠੀਕ ਹੈ ਜੀ ਅਤੇ ਉਹਨਾਂ ਦੀ ਹੋਮ ਡਿਲੀਵਰੀ ਫਰੀ ਹੈ ਅੱਛਾ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਓਕੇ ਧੰਨਵਾਦ ਜੀ ਤੁਹਾਡਾ